ਮੇਰੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਹੇਠ ਲਿਖੇ ਅਨ ਇਹ ਇਸ ਤਰ੍ਹਾਂ ਹਨ ਮੇਰੇ ਵਿੱਚ ਮੈਂ ਮੇਰੇ ਵਿੱਚ ਬਹੁਤ ਹੀ ਸ਼ਕਤੀਆਂ ਹਨ ਮੈਂ ਹਰ ਕੰਮ ਬਹੁਤ ਹੀ ਇਮਾਨਦਾਰੀ ਲਗਨ ਅਤੇ ਮਿਹਨਤ ਨਾਲ ਕਰਦੀ ਹਾਂ ਜੇਕਰ ਮੈਂ ਕੋਈ ਕੰਮ ਕਰ ਕਰਨਾ ਸ਼ੁਰੂ ਕਰ ਦਿੰਦੀ ਹਾਂ ਤਾਂ ਮੈਂ ਉਸ ਕੰਮ ਨੂੰ ਖ਼ਤਮ ਕਰਕੇ ਹੀ ਹੱਟਦੀ ਹਾਂ ਅਤੇ ਮੈਂ ਹਰ ਕੰਮ ਨੂੰ ਪੂਰੇ ਮਿਹਨਤ ਨਾਲ ਕਰਦੀ ਹਾਂ ਮੇਰੀ ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਮੈਂ ਸਮਾਜ ਵਿੱਚ ਅੱਗੇ ਵੱਧਣਾ ਚਾਹੁੰਦੀ ਹਾਂ ਪਹਿਲੇ ਸਮੇਂ ਵਿੱਚ ਕੁੜੀਆਂ ਨੂੰ ਪੜ੍ਹਨ ਨਹੀਂ ਸੀ ਦਿੱਤਾ ਜਾਂਦਾ ਜਿਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਂ ਪੜ੍ਹ ਲਿਖ ਕੇ ਅੱਗੇ ਵਧਾ ਮੈਂ ਵੀ ਕੋਈ ਨਾ ਕੋਈ ਕੰਮ ਕਰ ਸਕਾਂ ਅਤੇ ਸਮਾਜ ਵਿੱਚ ਮੈਂ ਡਟ ਕੇ ਮੁਕਾਬਲਾ ਕਰ ਸਕਾਂ ਹਰ ਮੁਸੀਬਤ ਦਾ ਅਸ ਮੈਂ ਵੀ ਚਾਹੁੰਦੀ ਹਾਂ ਕਿ ਮੈਂ ਬਾਕੀ ਕੁੜੀਆਂ ਵਾਂਗ ਅੱਗੇ ਵਧਾ ਅਤੇ ਮੁੰਡਿਆਂ ਦਾ ਮੁਕਾਬਲਾ ਕਰ ਸਕਾਂ ਅਤੇ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਵੀ ਇਹ ਆ ਕਿ ਮੈਂ ਜੇਕਰ ਕੋਈ ਕੰਮ ਕਰਦੀ ਹਾਂ ਤਾਂ ਮੈਂ ਇੰਨਾ ਕੁ ਡੁੱਬ ਜਾਂਦੀ ਹਾਂ ਉਸ ਕੰਮ ਵਿੱਚ ਕਿ ਮੈਨੂੰ ਆਲੇ ਦੁਆਲੇ ਬਾਰੇ ਕੁਝ ਨਹੀਂ ਪਤਾ ਹੁੰਦਾ ਇਸ ਕਰਕੇ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ